ਖੇਡਾਂ ਜਿਹੜੀਆਂ ਹੈਗੀਆਂ ਸਾਡੇ ਸਰੀਰਕ ਅਤੇ ਮਾਨਸਿਕ ਦੋਨਾਂ ਨੂੰ ਜਿਹੜੀ ਹੈਗੀਆਂ ਉਹ ਤਰੋ ਤਾਜ਼ਾ ਤੰਦਰੁਸਤ ਰੱਖਦੀਆਂ ਹਨ ਕਿਉਂਕਿ ਕਹਿੰਦੇ ਹੈਗੇ ਖਿਡਾਰੀ ਦੇ ਵਿੱਚ ਇੱਕ ਜਿਹੜਾ ਚੰਗੀ ਚੰਗਾ ਖਿਡਾਰੀ ਖੇਡਦਾ ਹੈ ਉਹਦਾ ਮਨ ਵੀ ਉਨਾਂ ਵਧੀਆ ਬਣ ਜਾਂਦਾ ਹੈ ਉਹਦੇ ਵਿੱਚ ਉਨੀਂ ਪੌਜ਼ੀਟੀਵਿਟੀ ਅਤੇ ਵਿਟੀ ਆ ਜਾਂਦੀ ਹੈ ਕਿਉਂਕਿ ਉਹ ਆਪਣੀ ਖੇਡ ਬੰਨੀ ਬੜਾ ਧਿਆਨ ਦਿੰਦਾ ਹੈ ਅਤੇ ਜਿਹੜਾ ਖੇਡ ਬੰਨੀ ਧਿਆਨ ਦਿੰਦਾ ਹੈ ਉਹਦਾ ਸਰੀਰ ਦਾ ਵਿਕਾਸ ਹੋਣ ਦੇ ਨਾਲ਼ ਉਹਦਾ ਮਨ ਦਾ ਵਿਕਾਸ ਵੀ ਹੋ ਜਾਂਦਾ ਹੈ ਧੰਨਵਾਦ